ਮੈਂ ਪ੍ਰੇਮ ਸਿੰਘ ਨਿਵਾਸੀ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਗੱਲ ਕਰਾਂ ਜੇ ਸਾਡੀ ਸਰਕਾਰ ਦੇ ਨੇ ਪੇਂਡੂ ਖੇਤਰ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕੀ ਕੁਝ ਕਦਮ ਚੁੱਕੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਸਾਡੀਆਂ ਸਰਕਾਰਾਂ ਪਿੰਡਾਂ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਹੁਤ ਬੇ ਬਹਾਲ ਬਣਾਉਣ ਵਾਸਤੇ ਕਈ ਕੁਛ ਕਰ ਰਹੀਆਂ ਹਨ ਜਿਵੇਂ ਕਿ ਉਹ ਨਵੇਂ ਸਕੂਲ ਖੋਲ੍ਹਣ ਖੋਲ੍ਹ ਰਹੇ ਹਨ ਨਵੇਂ ਕਾਲਜ ਖੋਲ੍ਹੇ ਜਾ ਰਹੇ ਹਨ ਜਿਸ ਵਿੱਚ ਹਰ ਚੀਜ਼ ਜੋ ਬੱਚੇ ਨੂੰ ਚਾਹੀਦੀ ਹੈ ਉਹ ਉੱਥੇ ਉਪਲਬਧ ਹੁੰਦੀ ਹੈ ਸਾਡੀ ਸਰਕਾਰ ਆਪਣੇ ਇਲਾਕੇ ਵਿੱਚ ਇਲਾਕੇ ਵਿੱਚ ਦੀ ਬਦੌਲਤ ਬੜੀ ਤਰੰਗ ਦੇ ਸਕੂਲ ਬੜੀ ਤਰ੍ਹਾਂ ਦੇ ਸਕੂਲ ਸਿੱਖਿਆ ਸੰਸਥਾਵਾਂ ਚਲਾ ਰਹੀ ਹੈ ਜਿਵੇਂ ਕਿ ਛੋਟੇ ਛੋਟੇ ਲੈਬ ਵਿੱਚ ਪੰਜਵੀਂ ਕਲਾਸ ਤੱਕ ਪ੍ਰਾਇਮਰੀ ਸਕੂਲ ਹੁੰਦੇ ਹਨ ਅੱਠਵੀਂ ਸਕੂਲ ਅੱਠਵੀਂ ਜਮਾਤ ਤੱਕ ਮਿਡਲ ਸਕੂਲ ਹੁੰਦੇ ਹਨ ਅਤੇ ਦੇਰ ਅਤੇ ਹਾਈ ਸਕੂਲ ਹਨ ਅੱਜ ਕੱਲ੍ਹ ਸਾਡੇ ਸਮਾਜ ਵਿੱਚ ਕੋਈ ਵੀ ਅਜਿਹਾ ਪਿੰਡ ਨਹੀਂ ਹੈ ਜਿੱਥੇ ਪ੍ਰਾਇਮਰੀ ਜਾਂ ਸਰਕਾਰੀ ਮਿਡਲ ਸਕੂਲ ਨਾ ਹੋਵੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਇਹ ਸਰਕਾਰ ਦਾ ਹੀ ਉਪਰਾਲਾ ਹੈ ਕਿ ਸਰਕਾਰ ਉਸਦੇ ਮੁਫਤ ਪੜ੍ਹਾਈ ਕਿਤਾਬਾਂ ਵਰਦੀ ਭੋਜਨ ਆਦਿ ਦਿੰਦੀ ਹੈ ਸਰਕਾਰ ਹੀ ਸਰਕਾਰ ਦੇ ਹੀ ਉਪਰਾਲੇ ਹਨ ਸਾਡੇ ਬੱਚਿਆਂ ਨੂੰ ਲਾਭਕਾਰੀ ਬਣਾਉਂਦੇ ਹਨ ਆਉ ਸਾਰੇ ਰਲ ਮਿਲ ਕੇ ਬੱਚਿਆਂ ਨੂੰ ਇਹਨਾਂ ਸਕੂਲਾਂ ਵਿੱਚ ਪੜ੍ਹਾਈਏ ਆਉ ਸਾਰੇ ਰਲ ਮਿਲ ਰਲ ਕੇ ਇਹ ਪ੍ਰਣ ਲਈਏ ਅਤੇ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਵਿੱਚ ਪੜ੍ਹਾਈ ਕਰਵਾਈਏ ਧੰਨਵਾਦ ਜੀ